ਸਤਿ ਸ਼੍ਰੀ ਅਕਾਲ ਭਾਅ ਜੀ ਤੁਸੀਂ ਕੁਮਾਰ ਇਲੈਕਟ੍ਰੋਨਿਕਸ ਤੋਂ ਬੋਲਦੇ ਹੋ ਮੈਂ ਦਰਅਸਲ ਤੁਹਾਡਾ ਧੰਨਵਾਦ ਕਰਨ ਲਈ ਫੋਨ ਕੀਤਾ ਹੈ ਜਿਹੜਾ ਮੈਂ ਤੁਹਾਨੂੰ ਪਹਿਲੀ ਵਾਰ ਔਨਲਾਈਨ ਪ੍ਰੋਡਕਟ ਔਡਰ ਕੀਤਾ ਸੀ ਉਹ ਸਮੇਂ ਸਿਰ ਪਹੁੰਚ ਗਿਆ ਹੈ ਅਤੇ ਪਹਿਲੀ ਗੱਲ ਉਹਦੀ ਤਾਂ ਪੈਕਿੰਗ ਹੀ ਬਹੁਤ ਵਧੀਆ ਸੀ ਮੈਂ ਉਹੀ ਦੇਖ ਕੇ ਬਹੁਤ ਖੁਸ਼ ਹੋ ਗਈ ਫੋਨ ਜਦੋਂ ਮੈਂ ਪੈਕਿੰਗ ਚੋਂ ਬਾਹਰ ਕੱਢਿਆ ਤਾਂ ਉਸਦਾ ਰੰਗ ਅਤੇ ਉਹਦੀ ਬੈਟਰੀ ਪੈਕਅਪ ਵਗੈਰਾ ਸਭ ਕੁਛ ਬਹੁਤ ਹੀ ਵਧੀਆ ਸੀ ਅਕਸਰ ਕੀ ਹੁੰਦਾ ਹੈ ਕਿ ਜਦੋਂ ਵੀ ਆਪਾਂ ਕੋਈ ਔਨਲਾਈਨ ਔਡਰ ਕਰਦੇ ਹਾਂ ਤਾਂ ਉਸਦੇ ਵਿੱਚ ਕੋਈ ਨਾ ਕੋਈ ਕਮੀ ਹੁੰਦੀ ਹੈ ਜਾਂ ਉਹਨੂੰ ਖਰਾਬੀ ਵੀ ਕਹਿ ਸਕਦੇ ਹਾਂ ਖਰਾਬ ਚੀਜ਼ ਨਿਕਲਦੀ ਹੈ ਉਹਦੇ ਵਿੱਚ ਬਹੁਤ ਸਾਰੀਆਂ ਕਮੀਆਂ ਨਿਕਲਦੀਆਂ ਹਨ ਪਰ ਇਹ ਔਡਰ ਵਿੱਚ ਮੈਨੂੰ ਕੋਈ ਵੀ ਕਮੀ ਖਰਾਬੀ ਨਹੀਂ ਦਿਖਾਈ ਦਿੱਤੀ ਮੈਂ ਇਹ ਪ੍ਰੋਡਕਟ ਲੈ ਕੇ ਬਹੁਤ ਖੁਸ਼ ਹਾਂ ਆਪ ਜੀ ਨੇ ਜਿਹੜਾ ਜਿਹੜਾ ਇਹ ਫੋਨ ਮੈਨੂੰ ਔਨਲਾਈਨ ਭੇਜਿਆ ਹੈ ਬਹੁਤ ਹੀ ਵਧੀਆ ਕਿਸਮ ਦਾ ਹੈ ਇਸਦੀ ਬੈਟਰੀ ਪੈਕਅਪ ਵੀ ਬਹੁਤ ਵਧੀਆ ਹੈ ਅਤੇ ਇਹ ਔਡਰ ਮੈਂ ਆਪਣੀਆਂ ਸਹੇਲੀਆਂ ਦੇ ਕਹਿਣ 'ਤੇ ਔਡਰ ਕੀਤਾ ਸੀ ਜੋ ਕਿ ਮੇਰਾ ਬਹੁਤ ਹੀ ਵਧੀਆ ਤਜਰਬਾ ਰਿਹਾ ਆਪ ਜੀ ਦਾ ਬਹੁਤ ਬਹੁਤ ਧੰਨਵਾਦ